ਭੰਗੜੇ ਦੇ ਵੈਸੇ ਤਾਂ ਬਹੁਤ ਸਾਰੇ ਸਟੈਪ ਹਨ ਪਰ ਕੁਝ ਭੰ ਸਟੈਪ ਜਿਹੜੇ ਬਹੁਤ ਮਸ਼ਹੂਰ ਮੰਨੇ ਜਾਂਦੇ ਹਨ ਪਟਾਕਾ ਧਮਾਲ ਲੁੱਡੀ ਝੂੰਮਰ ਚਾਲ ਤੁਰਨਾ ਇਹ ਕੁਝ ਖ਼ਾਸ ਸਟੈਪ ਹਨ ਇਹ ਸਟੈਪ ਜਿਹੜੇ ਕਿਸੀ ਵੀ ਖੁਸ਼ੀ ਦੇ ਮੌਕੇ 'ਤੇ ਜਾਂ ਕਿਸੇ ਵੀ ਫੰਕਸ਼ਨ 'ਤੇ ਜਾਂ ਜਿੱਦਾਂ ਆਜ਼ਾਦੀ ਛੱਬੀ ਜਨਵਰੀ ਪੰਦਰ੍ਹਾਂ ਅਗਸਤ ਦੇ ਮੇ ਇੱਦਾਂ ਪ੍ਰੋਗਰਾਮਾਂ 'ਤੇ ਜਾਂ ਮੇਲਿਆਂ ਵਿੱਚ ਢੋਲ ਦੀ ਤਾਲ ਨਾਲ ਬਹੁਤ ਹੀ ਵਧੀਆ ਢੰਗ ਨਾਲ ਭੰਗੜੇ ਵਾਲੇ ਮੁੰਡੇ ਇਹਨਾਂ ਆਈਟਮਾਂ ਨੂੰ ਕਰਦੇ ਹਨ ਤਾਂ ਜੋ ਇਹਨਾਂ ਆਈਟਮਾਂ ਦੇ ਲਈ ਤੁਰਲੇ ਵਾਲੀਆਂ ਪੱਗਾਂ ਚਾਦਰੇ ਲਾ ਕੇ ਜਿਹਲੇ ਮੁੰਡੇ ਇਹ ਭੰਗੜਾ ਪਾਉਂਦੇ ਹਨ ਅਤੇ ਬਹੁਤ ਹੀ ਵਧੀਆ ਲੱਗਦਾ ਹੈ ਤਾਂ ਇਹ ਸਾਡੇ ਇੱਕ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਕਲਚਰ ਨੂੰ ਸ ਦਿਖਾ ਦਿਖਾਉਂਦਾ ਹੈ ਕਿ ਪੰਜਾਬ ਦੇ ਵਿੱਚ ਗੱਭਰੂ ਜਿਸਲੇ ਚਾਦਰੇ ਲਾ ਕੇ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਮੈਦਾਨ ਵਿੱਚ ਭੰਗੜਾ ਪਾਉਣ ਲਈ ਉਤਰਦੇ ਹਨ ਅਤੇ ਉਹਨਾਂ ਦਾ ਰੂਪ ਅਲੱਗ ਹੀ ਹੁੰਦਾ ਹੈ ਤਾਂ ਇਹ ਇੱਕ ਸਾਡੇ ਸੱਭਿਆਚਾਰ ਦੀ ਇੱਕ ਪਹਿਚਾਣ ਵੀ ਹੈ ਪੰਜਾਬ ਦੇ ਵਿੱਚ ਭੰਗੜੇ ਨੂੰ ਬਹੁਤ ਹੀ ਵਧੀਆ ਅਤੇ ਚੰਗੇ ਢੰਗ ਨਾਲ ਕੀਤਾ ਜਾਂਦਾ ਹੈ ਤੋ ਜੋ ਕਿ ਭੰਗੜਾ ਹੈ ਇਹ ਇੱਕ ਸਾਡੇ ਪੰਜਾਬ ਦੀ ਇਕ ਖ਼ਾਸ

ਖ਼ਾਸ ਧਰੋਹਰ ਹੈ ਅੱਜ ਕੱਲ੍ਹ ਪਤਾ ਭੰਗੜੇ ਦਾ ਜੋ ਪ੍ਰੋਗਰਾਮ ਹੈ ਇਹ ਅਗਾਂਹ ਅਤੇ ਅਗਾਂਹ ਘਟੀ ਜਾਂਦਾ ਹੈ ਪਰ ਕਿਓਂ ਲੋਕਾਂ ਨੇ ਹੁਣ ਭੰਗੜੇ ਨੂੰ ਸਿੱਖਣ ਵਾਸਤੇ ਸ ਕਈ ਸਕੂਲ ਖੋਲ੍ਹੇ ਗਏ ਹਨ ਕਿਉਂਕਿ ਇਹ ਆਪਣੇ ਸਾਡੇ ਸਰੀਰ ਵਾਸਤੇ ਵੀ ਬਹੁਤ ਵਧੀਆ ਹੈ ਭੰਗੜੇ ਦੇ ਨਾਲ ਸਾਡਾ ਸਰੀਰ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ ਮਜ਼ਬੂਤ ਹੁੰਦਾ ਹੈ